ਜਿਵੇਂ ਮੈਂ ਪੰਜਾਬ ਦੀ ਵਾਸੀ ਹਾਂ ਹੈ ਨਾ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਕ ਇਹੋ ਜਿਹੇ ਅਕਾਲੀ ਦਲ ਦੇ ਮੰਤਰੀ ਹੋਏ ਨੇ ਸੀ ਐੱਮ ਬਣੇ ਸੀਗੇ ਉਹ ਪੰਜਾਬ ਦੇ ਚੀਫ਼ ਮਨਿਸਟਰ ਬਣੇ ਸੀਗੇ ਜਿਨ੍ਹਾਂ ਨੇ ਪੰਜਾਬ ਵਿੱਚ ਬੜੀ ਜ਼ਿਆਦਾ ਤਰੱਕੀ ਕੀਤੀ ਜਿਨ੍ਹਾਂ ਨੇ ਸੜਕਾਂ ਦੀ ਪੰਜਾਬ ਦੀ ਪੂਰੀ ਤਰ੍ਹਾਂ ਨੁਹਾਰ ਬਦਲ ਕੇ ਰੱਖ ਦਿੱਤੀ ਉਹਨਾਂ ਨੇ ਪੰਜਾਬ ਹੈਰੀਟੇਜ ਨੂੰ ਬੜ੍ਹਾਵਾ ਬੜ੍ਹਾਵਾ ਦਿੱਤਾ ਸੜਕਾਂ ਦੀ ਬਹੁਤ ਜ਼ਿਆਦਾ ਵਧੀਆ ਤਰ੍ਹਾਂ ਸੜਕਾਂ ਦਾ ਨਿਰਮਾਣ ਕਰਵਾਇਆ ਉਹਨਾਂ ਨੇ ਕਿਸਾਨਾਂ ਦੀ ਬੜੀ ਅੱਛੀ ਤਰ੍ਹਾਂ ਨਾਲ ਮਦਦ ਕੀਤੀ ਕਿਸਾਨਾਂ ਦਾ ਪੂਰਾ ਸਾਥ ਦਿੱਤਾ ਉਹਨਾਂ ਦੀ ਫਸਲਾਂ 'ਤੇ ਐੱਮ ਐੱਸ ਪੀ ਉਹਨਾਂ ਨੂੰ ਸਿੰਚਾਈ ਦੇ ਸਾਧਨ ਉਹਨਾਂ ਨੂੰ ਨਵੇਂ ਨਵੇਂ ਸੰਦਾਂ ਨਾਲ ਕਿਸਾਨਾਂ ਨੂੰ ਪੂਰੀ ਹੀ ਮਦਦ ਦਿੱਤੀ ਉਹਨਾਂ ਨੇ ਪੰਜਾਬ ਵਿੱਚ ਆਟਾ ਦਾਲ ਸਕੀਮ ਚਲਾਈ ਜਿਹਦੇ ਨਾਲ ਕਿ ਕੋਈ ਵੀ ਪਰਿਵਾਰ ਬਿਨਾਂ ਰੋਟੀ ਤੋਂ ਭੁੱਖਾ ਨਹੀਂ ਸੀ ਸੌਂਦਾ ਆਟਾ ਦਾਲ ਦੀ ਸਕੀਮ ਅਜੇ ਤੱਕ ਵੀ ਉਹਨਾਂ ਦੁਆਰਾ ਚਲਾਈ ਗਈ ਚੱਲਦੀ ਪਈ ਹੈ ਪੰਜਾਬ ਵਿੱਚ ਉਹਨਾਂ ਨੇ ਗਰੀਬਾਂ ਦੀ ਬਾਂਹ ਫੜਨ ਵ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਉਹ ਗਰੀਬਾਂ ਦੇ ਮਸੀਹਾ ਵੀ ਕਹਿਲਾਏ ਧੰਨਵਾਦ